ਮੈਂ ਕਡਾਈਆਂ ਸਿੰਦੀ ਕੱਚਾ ਟਾਂਕਾ ਸ਼ੇਡ ਆਰੀ ਦੀਆਂ ਕੜਾਈਆਂ ਸਿੱਪੀ ਮੋਤੀ ਸਭ ਲਗਾਨੀ ਕੱਢ ਚੁੱਕੀ ਹਾਂ ਮੇਰਾ ਪਸੰਦ ਦਾ ਡਿਜ਼ਾਇਨ ਕੱਚਾ ਟਾਂਕਾ ਹੈ ਜਦੋਂ ਕੋਈ ਉਖੜ ਜਾਏ ਅਸੀਂ ਕੱਢਦੇ ਹਾਂ ਤਾਂ ਸਾਨੂੰ ਨਹੀਂ ਸਮਝ ਆ ਰਿਹਾ ਜਾ ਵੱਡਿਆਂ ਕੋਲੋਂ ਪੁੱਛ ਲੈਂਦੇ ਹਾਂ ਜਾਂ ਯੂਟੀਊਬ ਦੀ ਮਦਦ ਨਾਲ ਕੱਢ ਲੈਂਦੇ ਹਾਂ ਫਿਰ ਇਸ ਦੀ ਵਾਰ ਵਾਰ ਪ੍ਰੈਕਟਿਸ ਕਰਦੇ ਹਾਂ ਪ੍ਰੈਕਟਿਸ ਕਰਨ ਦੇ ਤਾਂ ਉਹ ਆ ਜਾਂਦਾ ਹੈ ਜਾ ਪੁਰਾਣੇ ਲੋਗ ਜਿਨਾਂ ਨੂੰ ਆਉਂਦਾ ਹੈ ਉਹਨਾਂ ਦੀ ਮਦਦ ਕਰ ਲੈਦੇ ਹਾਂ ਮੈਨੂੰ ਕੱਚਾ ਟਾਂਕਾ ਕੱਢਣਾ ਬਹੁਤ ਪਸੰਦ ਹੈ ਉਸਨੂੰ ਤਾਂ ਮੈਂ ਇੱਕ ਦਿਨ ਵਿੱਚ ਹੀ ਸੂਟ ਪੂਰਾ ਕਰ ਦਿੰਦੀ ਹਾਂ ਜਿਸ ਲਈ ਕੜਾਈ ਮੇਰਾ ਸਭ ਤੋਂ ਵਧੀਆ ਟੀਚਾ ਹੈ